ਪੰਜਾਬ ਸਰਕਾਰ ਨੇ ਕਾਨੂੰਨ ਕਈ ਕਾਨੂੰਨ ਪਾਸ ਕੀਤੇ ਹੋਏ ਹਨ ਜਿਵੇਂ ਕਿ ਕ੍ਰਿਮੀਨਲ ਕੋਰਸ ਨੂੰ ਕੋਈ ਕੁਝ ਕੇਸ ਤਾਂ ਛੋਟੇ ਲੈਵਲ 'ਤੇ ਜਿਵੇਂ ਕਿ ਮਹੀਨੇ ਦੋ ਮਹੀਨਿਆਂ ਵਿੱਚ ਵਾਰੀ ਆ ਜਾਂਦੀ ਹੈ ਕਈਆਂ ਕੇਸਾਂ ਨੂੰ ਥੋੜ੍ਹਾ ਸਮਾਂ ਵੀ ਲੱਗ ਜਾਂਦਾ ਹੈ ਸਰਕਾਰ ਆਪਣੇ ਸਾਰੇ ਕੇਸਾਂ ਨੂੰ ਹੱਲ ਕਰਨ ਲਈ ਪੂਰੇ ਯਤਨ ਕਰਦੀ ਹੈ ਸਰਕਾਰ ਇਹ ਕੋਸ਼ਿਸ਼ ਹੈ ਕਿ ਹਰੇਕ ਆਦਮੀ ਨੂੰ ਨਿਆਏ ਦਿੱਤਾ ਜਾਏ ਕਿਸੇ ਦੇ ਨਾਲ ਵੀ ਕੁਛ ਗਲਤ ਨਾ ਹੋਵੇ ਅਗਰ ਕੋਈ ਅਪਰਾਧ ਕਰਦਾ ਹੈ ਤਾਂ ਉਸਨੂੰ ਉਸਦੀ ਬਣਦੀ ਸਜਾ ਜ਼ਰੂਰ ਦਿੱਤੀ ਜਾਂਦੀ ਹੈ ਤਾਂ ਕਿ ਦੁਬਾਰਾ ਪੰਜਾਬ ਵਿੱਚ ਅਜਿਹਾ ਘਟਨਾਵਾਂ ਨਾ ਹੋਣ ਹਾਈ ਕੋਰਟ ਬਣੀ ਹੈ ਸੁਪਰੀਮ ਕੋਰਟ ਬਣੀ ਹੈ ਲੋਕਲ ਕੋਰਟ ਬਣੀ ਹੈ ਇਹਦੇ ਤੋਂ ਇਲਾਵਾ ਵੀ ਕੁਝ ਕਈ ਕਈ ਐਸੇ ਕੇਸ ਹਨ ਜਿਨ੍ਹਾਂ ਨੂੰ ਛੋਟੀਆਂ ਅਦਾਲਤਾਂ ਦੇ ਵਿੱਚ ਹੱਲ ਕੀਤਾ ਜਾਂਦਾ ਹੈ ਸਰਕਾਰ ਨੇ ਪੂਰਾ ਪੂਰਾ ਯਤਨ ਕੀਤਾ ਹੈ ਕਿ ਜੇ ਕੋਈ ਅਪਰਾਧ ਨੇ ਉਨ੍ਹਾਂ ਨੂੰ ਐਵੇਂ ਨਾ ਛੱਡਿਆ ਜਾਏ ਤਾਂ ਕਿ ਅਪਰਾਧੀ ਅੱਗੇ ਵੱਧ ਕੇ ਹੋਰ ਹੋਰ ਇਹੋ ਜਿਹੇ ਕੰਮ ਨਾ ਕਰਨ ਜਿਸ ਨਾਲ ਕਿ ਸਾਡੇ ਰਾਜ ਦਾ ਮਹੌਲ ਹੈ ਜੋ ਖ਼ਰਾਬ ਹੋਏ ਸਰਕਾਰ ਪੂਰੀ ਤਰ੍ਹਾਂ ਸਾਨੂੰ ਆਸ਼ਵਾਸਨ ਦਵਾਉਂਦੀ ਹੈ ਕਿ ਜੋ ਵੀ ਕੇਸ ਨੇ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਹੱਲ ਕੀਤਾ ਜਾਵੇ ਅਗਰ ਔਰਤਾਂ ਨਾਲ ਕੁਛ ਗਲਤ ਹੋ ਰਿਹਾ ਤਾਂ ਉਸਨੂੰ ਪਹਿਲ ਦੇ ਅਧਾਰ 'ਤੇ ਲਿਆ ਜਾਵੇ ਜਿਹੜਾ ਵੀ ਬੰਦਾ ਆਪਣਾ ਕੇਸ ਦਰਜ ਕਰਦਾ ਹੈ ਉਸਦੀ ਸੁਣਵਾਈ ਲਈ ਲੋੜੀਂਦੇ ਯਤਨ ਕੀਤੇ ਜਾਂਦੇ ਹਨ ਟਾਈਮ ਦਿੱਤਾ ਜਾਂਦਾ ਹੈ ਉਨ੍ਹਾਂ ਨੂੰ ਪ੍ਰੋਪਰ ਤਾਂ ਜੋ ਉਨ੍ਹਾਂ ਦੇ ਕੇਸ ਜਿਹੜੇ ਹੈ ਜਲਦੀ ਹੱਲ ਕੀਤੇ ਜਾਂਦੇ ਹਨ ਧੰਨਵਾਦ